ਮੈਂ ਪੰਜਾਬ 'ਚ ਰਹਿੰਦਾ ਹਾਂ ਅਤੇ ਮੈਂ ਮੁਰਗੀ ਪਾਲਣ ਦਾ ਕੰਮ ਕਰਦਾ ਹਾਂ ਅਤੇ ਮੈਨੂੰ ਉਹਨਾਂ ਵਿੱਚ ਕਾਫੀ ਜ਼ਿਆਦਾ ਮੁਨਾਫਾ ਮਿਲਦਾ ਹੈ ਮੈਂ ਚਾਰ ਮੁਰਗੇ ਮੁਰਗੀਆਂ ਤੋਂ ਸਟਾਰਟ ਕੀਤਾ ਸੀਗਾ ਜਿਸ ਵਿੱਚ ਮੇਰੇ ਕੋਲ ਤਿੰਨ ਸੌ ਤਿੰਨ ਸੌ ਤੋਂ ਜ਼ਿਆਦਾ ਮੁਰਗੇ ਮੁਰਗੀਆਂ ਹਨ ਮੈਂ ਉਹਨਾਂ ਦਾ ਮੀਟ ਵੇਚ ਕੇ ਪੈਸੇ ਕਾਫੀ ਜ਼ਿਆਦਾ ਪੈਸੇ ਕਮਾਈ ਕਰਦਾ ਹਾਂ ਇਸ ਤੋਂ ਬਾਵਜੂਦ ਮੈਂ ਉਹਨਾਂ ਦੇ ਅੰਡੇ ਵੀ ਵੇਚ ਲੈਂਦਾ ਹਾਂ ਡੇਢ ਦੋ ਸੌ ਡੇਢ ਸੌ ਤੋਂ ਲੈ ਕੇ ਦੋ ਸੌ ਅੰਡਾ ਹਰ ਮਹੀਨੇ ਮੇਰੇ ਕੋਲ ਹੋ ਜਾਂਦਾ ਹੈ ਉਹਨਾਂ ਨੂੰ ਵੇਚ ਕੇ ਮੈਨੂੰ ਕਾਫੀ ਜ਼ਿਆਦਾ ਵਧੀਆ ਆਮਦਨ ਹੋ ਰਹੀ ਹੈ ਇਸ ਤੋਂ ਇਲਾਵਾ ਮੈਂ ਜਿੰਨੇ ਵੀ ਮੁਰਗੇ ਰੱਖੇ ਹਨ ਮੇਰੇ ਕੋਲ ਮੀਟ ਦਾ ਆ ਵੀ ਕਾਫੀ ਜ਼ਿਆਦਾ ਉਤਪਾਦ ਹੈ ਅਤੇ ਉਹਨਾਂ ਦੇ ਬਿੱਠ ਦੀ ਜੋ ਖਾਦ ਬਣਦੀ ਹੈ ਮੈਂ ਉਹ ਵੀ ਵੇਚ ਲੈਂਦਾ ਹਾਂ ਅਤੇ ਉਹ ਸਾਡੇ ਪਿੰਡ ਦੇ ਨੇੜੇ ਪੈਂਦੇ ਲੋਕ ਲੈ ਜਾਂਦੇ ਹਨ ਜੋ ਕਿ ਆਪਣੇ ਖੇਤਾਂ ਵਿੱਚ ਖਾਦ ਦੀ ਥਾਂ 'ਤੇ ਪਾ ਲੈਂਦੇ ਹਨ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੈਂ ਆਪਣਾ ਕਾਰੋਬਾਰ ਕਰ ਰਿਹਾ ਹਾਂ ਅਤੇ ਜ਼ਿਆਦਾ ਮੋਟੀ ਕਮਾਈ ਤਾਂ ਨਹੀਂ ਪਰ ਆਪਣੀ ਆਮਦਨ ਦੇ ਹਿਸਾਬ ਨਾਲ ਉਸ ਤੋਂ ਮੇਰਾ ਦਾਲ ਰੋਟੀ ਚੱਲ ਰਿਹਾ ਹੈ ਅਤੇ ਜੋ ਅੰਡੇ ਦਾ ਰੇਟ ਹੈ ਉਹ ਗਰਮੀਆਂ ਨੂੰ ਮੈਂ ਘੱਟ ਰੇਟ 'ਤੇ ਵੇਚਦਾ ਹਾਂ ਕਿਉਂਕਿ ਗਰਮੀਆਂ ਨੂੰ ਖਰਾਬ ਹੋਣ ਦਾ ਡਰ ਰਹਿੰਦਾ ਹੈ ਅਤੇ ਸਰਦੀਆਂ ਨੂੰ ਠੀਕ ਰੇਟ ਮਿਲ ਜਾਂਦਾ ਹੈ ਇਸ ਵਿੱਚ ਮੈਨੂੰ ਬਹੁਤ ਖੁਸ਼ੀ ਹੈ ਅਤੇ ਮੈਂ ਆਪਣੇ ਮੁਰਗਿਆਂ ਨੂੰ ਟਾਈਮ ਸਿਰ ਵੈਕਸੀਨੇਸ਼ਨ ਵੀ ਕਰਵਾਉਂਦਾ ਹਾਂ